ਰਾਜਨੀਤਿਕ ਧਰਮ ਬਾਰੇ ਧਰਮ ਬਾਰੇ ਰਾਜਨੀਕ 'ਚ ਬਹੁਤ ਜ਼ਿਆਦਾ ਮਹੱਤਵ ਹੈ ਹਰ ਬੰਦਾ ਜੋ ਆਪਣੇ ਆਪਣੇ ਕਨੋ ਖੜ੍ਹੀ ਖੜ੍ਹਾ ਹੁੰਦਾ ਹੈ ਜਿਵੇਂ ਕਿ ਸਰਦਾਰ ਹੁੰਦੇ ਆ ਅਕਾਲੀ ਗਰੁੱਪ ਹੈ ਉਹ ਆਪਣੇ ਸਰਦਾਰ ਭਾਈਆਂ ਨੂੰ ਕਹਿੰਦੇ ਹਨ ਅਸੀਂ ਸਰਦਾਰ ਹਨ ਅਸੀਂ ਸਰਦਾਰਾਂ ਨੂੰ ਹੀ ਵੋਟ ਪਾਉਣੀ ਚਾਹੀਦੀ ਹੈ ਆਪਣੇ ਧਰਮ ਨੂੰ ਅੱਗੇ ਰੱਖ ਕੇ ਇਹ ਵੋਟਾਂ 'ਚ ਖੜ੍ਹੇ ਹੁੰਦੇ ਹਨ ਅਤੇ ਵੋਟਾਂ ਪਵਾਉਂਦੇ ਹਨ ਲੋਕਾਂ ਨੂੰ ਧਰਮ ਦੇ ਨਾਂ 'ਤੇ ਸੌਹਾਂ ਵੀ ਚੁਕਵਾਉਂਦੇ ਹਨ ਕਿ ਤੁਸੀਂ ਪੰਜਾਬੀ ਹੋ ਪੰਜਾਬੀ ਹੋ ਕੇ ਤੁਸੀਂ ਕਾਂਗਰਸ ਨੂੰ ਵੋਟ ਪਾਓਗੇ ਨਹੀਂ ਇਸ ਅਤੇ ਸਾਡੇ ਧਰਮ ਤੋਂ ਵਰਖਿਲਾਫ ਹੈ ਸਾਨੂੰ ਸੌਹਾਂ ਵੀ ਚੁਕਾਉਂਦੇ ਹਨ ਕਿ ਤੁਹਾਨੂੰ ਅਕਾਲੀ ਗਰੁੱਪ ਨੂੰ ਹੀ ਵੋਟ ਪਾਉਣੀ ਚਾਹੀਦੀ ਹੈ ਅਤੇ ਅਸੀਂ ਪੰਜਾਬ 'ਚ ਅਕ ਅਕਾਲੀ ਗਰੁੱਪ ਹੀ ਲੈਣ ਅਕਾਲੀ ਸਰਕਾਰ ਹੀ ਲਿਆਉਣੀ ਹੈ ਜਿਸ ਕਰਕੇ ਸਾਨੂੰ ਉਹਨਾਂ ਦੇ ਨਾਲ ਵੀ ਚੱਲਣਾ ਪੈਂਦਾ ਹੈ ਕਿਉਂਕਿ ਅਸੀਂ ਇੱਕ ਧਰਮ ਦੇ ਹੋ ਕੇ ਦੂਜੇ ਧਰਮ ਨਾਲ ਨਹੀਂ ਮਿਲ ਸਕਦੇ